ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੋਹਾਲੀ 'ਚ ਬਹੁਤ ਜ਼ਿਆਦੇ ਘੁੰਮਣ ਫਿਰਨ ਦੀਆਂ ਜਗ੍ਹਾਂ ਹੈ ਤੁਸੀਂ ਪੀ ਵੀ ਆਰ ਜਾ ਸਕਦੇ ਓ ਉੱਥੇ ਤੁਸੀਂ ਆਪਣੇ ਇੰਟਰਟੈਨਮੈਂਟ ਲਈ ਜਾ ਸਕਦੇ ਹੋ ਅਤੇ ਆਪਣਾ ਇੰਨਜੁਆਏਮੈਂਟ ਫੁੱਲ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਧਾਰਮਿਕ ਸਥਾਨ 'ਤੇ ਜਾਣਾ ਹੈ ਤਾਂ ਇੱਥੇ ਗੁਰਦੁਆਰਾ ਸਾਹਿਬ ਹੈਗਾ ਏ ਸਿੰਘ ਸ਼ਹੀਦਾਂ ਸੋਹਾਣਾ ਜੋ ਕਿ ਹਨੂੰਮਾਨ ਜੀ ਦੀ ਬਾਬਾ ਹਨੂੰਮਾਨ ਜੀ ਦੀ ਯਾਦ 'ਚ ਬਣਾਇਆ ਗਿਆ ਹੈ ਅਤੇ ਜੇਕਰ ਤੁਸੀਂ ਖਾਣ ਪੀਣ ਲਈ ਜਾਣਾ ਹੈ ਤਾਂ ਪਾਲ ਢਾਬਾ ਅਤੇ ਭੈਣਾਂ ਦਾ ਢਾਬਾ ਇੱਥੇ ਬਹੁਤ ਜ਼ਿਆਦੇ ਮਸ਼ਹੂਰ ਹੈ ਅਤੇ ਤੁਸੀਂ ਉੱਥੇ ਜਾ ਸਕਦੇ ਹੋ ਬਾਕੀ ਜੇ ਕੱਪੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੱਪੜੇ ਵੀ ਇੱਥੇ ਬਹੁਤ ਵਧੀਆ ਮਿਲ ਜਾਂਦੇ ਨੇ ਅਤੇ ਤੁਸੀਂ ਆਰਾਮ ਨਾਲ ਓਥੇ ਘੁੰਮ ਫਿਰ ਸਕਦੇ ਹੋ ਅਤੇ ਤੁਹਾਡਾ ਖਰਚਾ ਵੀ ਮਤਲਵ ਕੀ ਲਿਮਟ 'ਚ ਹੋਵੇਗਾ ਜ਼ਿਆਦਾ ਖਰਚਾ ਨੀ ਹੋਊਗਾ ਅਤੇ ਇਥੇ ਵਧੀਆ ਸਾਰਾ ਕੁੱਝ ਮਿਲਦਾ ਹੈ ਠੀਕ ਹੈ ਜੀ ਹਾਂਜੀ ਤੁਸੀਂ ਸੜਕ ਸੜਕਾਂ ਜੀ ਬਹੁਤ ਵਧੀਆ ਨੇ ਤੁਸੀਂ ਆਰਾਮ ਨਾਲ ਘੁੰਮ ਸਕਦੇ ਓ ਸੜਕਾਂ ਬਿਲਕੁਲ ਸਾਫ਼ ਨੇ ਅਤੇ ਇੱਥੇ ਬਹੁਤ ਜ਼ਿਆਦੇ ਪਾਰਕਾਂ ਵੀ ਹੈਗੀਆਂ ਨੇ ਜਿਹਦੇ ਵਿੱਚ ਤੁਸੀਂ ਆਰਾਮ ਨਾਲ ਬੈਠ ਸਕਦੇ ਹੋ ਆਪਣਾ ਖਾਣਾ ਪੀਣਾ ਵੀ ਖਾ ਸਕਦੇ ਓ ਅਤੇ ਘੁੰਮ ਫਿਰ ਵੀ ਸਕਦੇ ਹੋ ਇੱਥੇ ਬਹੁਤ ਵਧੀਆ ਵਧੀਆ ਜਿਹੜੀ ਜਗ੍ਹਾਵਾਂ ਹੈਗੀਆਂ ਨੇ ਤੁਸੀਂ ਇੱਥੇ ਆਪਣਾ ਸਾਰਾ ਘੁੰਮ ਫਿਰ ਸਕਦੇ ਹੋ ਹਾਂਜੀ ਜੇ ਅੱਜ ਹਾਂਜੀ ਹਾਂਜੀ ਜ਼ਰੂਰ ਬਾਕੀ ਜੇ ਤੁਹਾਨੂੰ ਹੋਰ ਜਾਣਕਾਰੀ ਦੇਣੀ ਹੋਈ ਤਾਂ ਤੁਸੀਂ ਸਾਨੂੰ ਆਰਾਮ ਨਾਲ ਆਪਣੀ ਕਾਲ ਕਰ ਸਕਦੇ ਓ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਫਿਰ ਆ ਜਿਓ ਕੱਲ੍ਹ ਨੂੰ ਆਪਾਂ ਚੱਲਦੇ ਆ ਘੁੰਮਣ ਹਾਂਜੀ ਬਾਏ